ਖੇਤੀਬਾੜੀ ਬਾਰੇ ਆਉਣ ਵਾਲੀ ਪੀੜ੍ਹੀ ਲਈ ਮੇੇਰੇ ਵੱਲੋਂ ਬਹੁਤ ਵੱਡਾ ਸੁਨੇਹਾ ਹੈ ਅਤੇ ਸੁਝਾਅ ਵੀ ਹੈ ਖੇਤੀਬਾੜੀ ਕਰਨ ਵਾਲਿਆਂ ਲਈ ਜਿਹੜੀ ਨਵੀਂ ਪੀੜ੍ਹੀ ਹੈ ਪਹਿਲਾਂ ਉਨ੍ਹਾਂ ਨੂੰ ਔਰਗੈਨਿਕ ਖੇਤੀ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਔਰਗੈਨਿਕ ਖੇਤੀ ਹੀ ਇਸ ਟਾਈਮ ਲਾਭਦਾਇਕ ਧੰਦਾ ਬਣ ਚੁੱਕਾ ਹੈ ਅਤੇ ਖੇਤੀਬਾੜੀ ਖੇਤਰ ਦੇ ਵਿੱਚ ਨਵੀਂ ਪੀੜ੍ਹੀ ਨੂੰ ਔਰਗੈਨਿਕ ਖੇਤੀ ਲਈ ਆਪਣੇ ਟਾਈਮ ਕੱਢ ਕੇ ਕਲਾਸਾਂ ਲਗਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਉਹ ਮੁੱਢਲੀ ਔਰਗੈਨਿਕ ਸਿੱਖਿਆ ਖੇਤੀਬਾੜੀ ਲਈ ਲੈ ਸਕੇ ਅਤੇ ਵਧੀਆ ਸੁਚਾਰੂ ਢੰਗ ਨਾਲ ਖੇਤੀਬਾੜੀ ਚੱਕਰ ਚਲਾ ਸਕੇ ਖੇਤੀਬਾੜੀ ਦੇ ਵਿੱਚ ਕੁਝ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਬਣਦੀ ਹੈ ਕਿ ਇਸਦੇ ਵਿੱਚ ਰੇਹ ਸਪਰੇਹ ਘੱਟ ਕੀਤਾ ਜਾਵੇ ਅਤੇ ਔਰਗੈਨਿਕ ਖੇਤੀ ਵੱਲ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਜਾਵੇ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਲਗਾਏ ਜਾਣ ਖੇਤੀਬਾੜੀ ਦੇ ਖੇਤਰ ਨੂੰ ਪ੍ਰਫੁੱਲਿਤ ਕੀਤਾ ਜਾਵੇ ਪਿੰਡ ਪਿੰਡ ਸ਼ਹਿਰ ਸ਼ਹਿਰ ਇਸਦਾ ਪ੍ਰਸਾਰ ਕੀਤਾ ਜਾਵੇ ਅੱਜ ਦੇ ਯੁੱਗ ਦੇ ਵਿੱਚ ਜਿਵੇਂ ਕਿ ਔਨਲਾਈਨ ਜਾਂ ਸ਼ੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਇਸ ਦੇ ਵਿੱਚ ਵੀਡੀਓਜ਼ ਅਪਲੋਡ ਕੀਤੀਆਂ ਜਾਣ ਅੋਰਨ ਔਰਗੈਨਿਕ ਖੇਤੀ ਦੇ ਲਈ ਜਿਹੜਾ ਵਧੀਆ ਸੁਚਾਰੂ ਢੰਗ ਪ੍ਰਕਿਰਿਆ ਅਪਣਾਈ ਜਾਵੇ ਜਿਵੇਂ ਕਿ ਅੱਜ ਇਸ ਪੰਜਾਬ ਦੀ ਪਵਿੱਤਰ ਧਰਤੀ ਦੀ ਨਿਊ ਜ਼ਰਨੇਸ਼ਨ ਪੀੜ੍ਹੀ ਆਪਣਾ ਮੁੱਢਲਾ ਕਿੱਤਾ ਖੇਤੀਬਾੜੀ ਛੱਡ ਕੇ ਬਾਹਰਾਂ ਨੂੰ ਬਾਹਰ ਐਵਰੋਡ ਕਨੇਡਾ ਅਮਰੀਕਾ ਜਰਮਨ ਫਰਾਂਸ ਜਾ ਰਹੀ ਹੈ ਤਾਂ ਉਸ ਨੂੰ ਕਿਧਰੇ ਨਾ ਕਿਧਰੇ ਨਕੇਲ ਜਾਂ ਨੱਥ ਪਾਈ ਜਾ ਸਕੇ ਅਤੇ ਖੇਤੀਬਾੜੀ ਔਰਗੈਨਿਕ ਢੰਗ ਅਤੇ ਵਧੀਆ ਤਰੀਕੇ ਦੇ ਨਾਲ ਕਰਕੇ ਆਪਣਾ ਗੁਜ਼ਾਰਾ ਵਧੀਆ ਕਰ ਸਕੇ